ਉਂਝ ਤਾਂ ਸਾਡੇ ਪਿੰਡ ਵਿੱਚ ਸਿਹਤ ਸੇਵਾਵਾਂ ਦੀ ਹਾਲਤ ਕੁਛ ਵਧੀਆ ਨਹੀਂ ਹੈ ਪਰ ਜੋ ਹੈ ਵੀ ਹੈ ਉਹ ਵੀ ਵਧੀਆ ਤਰੀਕੇ ਨਾਲ ਸਹੂਲਤਾਂ ਪ੍ਰਦਾਨ ਨਹੀਂ ਕਰਦੀ ਜੇਕਰ ਅਸੀਂ ਐਂਬੂਲੈਂਸ ਦੀ ਗੱਲ ਕਰੀਏ ਤਾਂ ਉਹ ਕਦੇ ਵੀ ਸਹੀ ਸਮੇਂ 'ਤੇ ਨਹੀਂ ਪਹੁੰਚਦੀ ਅਕਸਰ ਜਦੋਂ ਵੀ ਐਂਬੂਲੈਂਸ ਬੁਲਾਈ ਜਾਂਦੀ ਹੈ ਤਾਂ ਉਹ ਦਿੱਤੇ ਗਏ ਸਮੇਂ ਤੋਂ ਬਹੁਤ ਹੀ ਦੇਰ ਬਾਅਦ ਆਉਂਦੀ ਹੈ ਜਿਸ ਕਾਰਨ ਮਰੀਜ਼ਾਂ ਨੂੰ ਬਹੁਤ ਹੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰ ਮਰੀਜ਼ਾਂ ਦੀ ਹਾਲਤ ਗੰਭੀਰ ਹੁੰਦੀ ਹੈ ਪਰ ਪਰ ਐਂਬੂਲੈਂਸ ਸਹੀ ਸਮੇਂ 'ਤੇ ਨਾ ਆਉਣ ਕਾਰਨ ਉਹਨਾਂ ਦੀ ਹਾਲਤ ਬਹੁਤ ਹੀ ਜ਼ਿਆਦਾ ਨਾਜ਼ੁਕ ਹੋ ਜਾਂਦੀ ਹੈ ਇਸ ਤੋਂ ਇਲਾਵਾ ਗਰਭਵਤੀ ਔਰਤਾਂ ਨੂੰ ਵੀ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਸਹੀ ਸਮੇਂ 'ਤੇ ਹੋ ਹਸਪਤਾਲ ਨਹੀਂ ਪਹੁੰਚਾਈਆਂ ਜਾਂਦੀਆਂ ਅਤੇ ਕਈ ਵਾਰ ਤਾਂ ਐਂਬੂਲੈਂਸ ਮਰੀਜ਼ ਦੀ ਮੌਤ ਤੋਂ ਬਾਅਦ ਹੀ ਦਿੱਤੇ ਗਏ ਪਤੇ 'ਤੇ ਪਹੁੰਚਦੀ ਹੈ